ਸਾਡਾ ਦੇਸ਼ ਭਾਰਤ ਜਿੱਥੇ ਕਿ ਅਲੱਗ ਅਲੱਗ ਧਰਮਾਂ ਦੇ ਲੋਕ ਰਹਿੰਦੇ ਹਨ ਅਤੇ ਅਲੱਗ ਅਲੱਗ ਧਰਮਾਂ ਦੇ ਲੋਕ ਮਿਲ ਕੇ ਰਹਿੰਦੇ ਹਨ ਅਤੇ ਅਤੇ ਇਕੱਠੇ ਹੀ ਆਪਣਾ ਜੀਵਨ ਬਤੀਤ ਕਰਦੇ ਹਨ ਇਸੇ ਤਰ੍ਹਾਂ ਕਿ ਸਾਡੇ ਰਾਜ ਵਿੱਚ ਵੀ ਅਲੱਗ ਅਲੱਗ ਧਰਮਾਂ ਦੇ ਲੋਕ ਰਹਿੰਦੇ ਹਨ ਜਿੱਥੇ ਕਿ ਬਹੁਤ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਇੱਕ ਭਾਈਚਾਰਕ ਤਿਉਹਾਰਾਂ ਨੂੰ ਮਨਾਉਂਦੇ ਹਨ ਜਿਵੇਂ ਇਸ ਦੀ ਇੱਕ ਉਦਾਹਰਨ ਹੈ ਕਿ ਸਾਡੇ ਰਾਜ ਵਿੱਚ ਇੱਕ ਵਿਸਾਖੀ ਦਾ ਮੇਲਾ ਲੱਗਦਾ ਹੈ ਜਿਸ ਨੂੰ ਕਿ ਬਹੁਤ ਸਾਰੇ ਅਲੱਗ ਅਲੱਗ ਧਰਮਾਂ ਦੇ ਲੋਕ ਇਕੱਠੇ ਹੁੰਦੇ ਹਨ ਅਤੇ ਉਸ ਵਿਸਾਖੀ ਦੇ ਮੇਲੇ ਨੂੰ ਮਨਾਉਂਦੇ ਹਨ ਇਸ ਵਿਸਾਖੀ ਦੇ ਮੇਲੇ ਵਿੱਚ ਉਹ ਆਉਂਦੇ ਹਨ ਮੇਲੇ ਦੀ ਰੌਣਕਾਂ ਦਾ ਆਨੰਦ ਮਾਣਦੇ ਹਨ ਖਾਂਦੇ ਹਨ ਪੀਂਦੇ ਹਨ ਵ ਗੁਰੂ ਦਾ ਲੰਗਰ ਛਕਦੇ ਹਨ ਅਤੇ ਇਸ਼ਨਾਨ ਕਰਕੇ ਆਪਣੇ ਵਿਸਾਖੀ ਦਾ ਮੇਲਾ ਮਨਾਉਂਦੇ ਹਨ ਇਸ ਤਰ੍ਹਾਂ ਬਹੁਤ ਸਾਰੇ ਧਾਰਮਿਕ ਭਾਈਚਾਰੇ ਦੇ ਲੋਕ ਇਕੱਠੇ ਹੁੰਦੇ ਹਨ ਇੱਥੇ ਕੋਈ ਵੀ ਧਾਰਮਿਕ ਤੌਰ 'ਤੇ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ ਕਿਉਂਕਿ ਗੁਰੂ ਸਾਹਿਬ ਦਾ ਸੰਦੇਸ਼ ਹੈ ਕਿ ਹਰੇਕ ਧਰਮ ਦੇ ਲੋਕ ਗੁਰਦੁਆਰਿਆਂ ਵਿੱਚ ਜਾ ਸਕਦੇ ਹਨ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਰੋਕ ਟੋਕ ਨਹੀਂ ਲਗਾਈ ਜਾ ਸਕਦੀ ਧਰਮ ਧਰਮ ਲੋਕਾਂ ਨੂੰ ਇਸ ਤਰ੍ਹਾਂ ਹੀ ਇਕੱਠੇ ਕਰਦਾ ਹੈ ਕਿ ਸਾਨੂੰ ਹਰੇਕ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ